ਮੈਂ ਨੈਨਸੀ ਮੈਂ ਅੱਜ ਪਹਿਲੀ ਵਾਰ ਐਮਾਜ਼ੋਨ ਤੋਂ ਸ਼ੋਪਿੰਗ ਕਰਕੇ ਦੇਖੀ ਜੋ ਕਿ ਬਹੁਤ ਹੀ ਵਧੀ ਮੈਨੂੰ ਜੋ ਕਿ ਬਹੁਤ ਹੀ ਵਧੀਆ ਲੱਗੀ ਮੈਂ ਉਸ ਮੈਂ ਐਮਾਜ਼ੋਨ ਤੋਂ ਇੱਕ ਕੁੜਤੀ ਔਡਰ ਕੀਤੀ ਜੋ ਕਿ ਬਹੁਤ ਹੀ ਵਧੀਆ ਸੀ ਉਸ ਨੂੰ ਲਟਕਣ ਵੀ ਲੱਗੇ ਹੋਏ ਸਨ ਅਤੇ ਉਹ ਲਟਕਣਾਂ ਨਾਲ ਬਹੁਤ ਹੀ ਵਧੀਆ ਲੱਗ ਰਹੀ ਸੀ ਜਦੋਂ ਮੈਂ ਉਹ ਕੁੜਤੀ ਆਪਣੇ ਕੋਲਜ ਵਿੱਚ ਪਾ ਕੇ ਗਈ ਤਾਂ ਮੇਰੀਆਂ ਫਰੈਂਡਸ ਨੂੰ ਵੀ ਬਹੁਤ ਵਧੀਆ ਬਹੁਤ ਵਧੀਆ ਲੱਗੀ